ਮੈਨੂੰ ਬਚਪਨ ਤੋਂ ਹੀ ਖਾਣਾ ਬਣਾਉਣ ਦਾ ਬਹੁਤ ਸ਼ੌਕ ਆ ਮੈਂ ਛੋਟੀ ਹੁੰਦੀ ਤੋਂ ਹੀ ਆਪਣੇ ਮੰਮਾ ਨੂੰ ਅਤੇ ਆਪਣੀ ਦਾਦੀ ਨੂੰ ਦੇਖਦੀ ਹੁੰਦੀ ਸੀ ਖਾਣਾ ਬਣਾਉਂਦਿਆਂ ਅਤੇ ਉਦੋਂ ਤੋਂ ਹੀ ਮੇਰੀ ਵੀ ਰੁਚੀ ਪੈ ਗਈ ਕਿ ਮੈਂ ਵੀ ਖਾਣਾ ਬਣਾਉਣਾ ਸਿੱਖਾਂ ਮੈਂ ਅੱਜ ਤੱਕ ਕੋਈ ਵੀ ਰੈਸਪੀ ਇੰਟਰਨੈਟ ਦੀ ਯੂਜ ਨਹੀਂ ਕੀਤੀ ਮੈਂ ਇੰਟਰਨੈਟ ਤੋਂ ਖਾਣਾ ਬਣਾਉਣਾ ਨਹੀਂ ਸਿੱਖਿਆ ਮੈਂ ਜੋ ਵੀ ਖਾਣਾ ਬਣਾਉਣਾ ਸਿੱਖਿਆ ਹੈ ਉਹ ਆਪਣੀ ਮੰਮਾ ਅਤੇ ਦਾਦੀ ਜੀ ਤੋਂ ਹੀ ਸਿੱਖਿਆ ਵਾ ਕਿਉਂਕਿ ਉਹਨਾਂ ਦੇ ਜੋ ਹੱਥ ਦਾ ਸਵਾਦ ਆ ਉਹ ਮੈਨੂੰ ਬਹੁਤ ਪਸੰਦ ਆ ਅਤੇ ਸਾਡੀ ਸਾਰੀ ਫੈਮਿਲੀ ਨੂੰ ਹੀ ਉਹਨਾਂ ਦੇ ਹੱਥ ਦਾ ਖਾਣਾ ਖਾਣਾ ਬਹੁਤ ਪਸੰਦ ਆ ਇਸ ਲਈ ਮੈਂ ਕੋਈ ਵੀ ਰੈਸਪੀ ਇੰਟਰਨੈਟ ਤੋਂ ਸਿੱਖਣ ਦੀ ਬਜਾਏ ਜਾਂ ਕਿਸੇ ਹੋਰ ਤੋਂ ਸਿੱਖਣ ਦੀ ਬਜਾਏ ਆਪਣੀ ਮੰਮਾ ਅਤੇ ਦਾਦੀ ਜੀ ਤੋਂ ਸਿੱਖੀ ਕਿਉਂਕਿ ਉਹਨਾਂ ਦੇ ਜੋ ਹੱਥ ਦੇ ਵਿੱਚ ਸਵਾਦ ਆ ਉਹੀ ਸਵਾਦ ਕਿਤੇ ਨਾ ਕਿਤੇ ਮੇਰੇ ਹੱਥ ਦੇ ਵਿੱਚ ਵੀ ਆ ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਖਾਣਾ ਬੋਣਾ ਬਣਾਉਣਾ ਬਹੁਤ ਪਸੰਦ ਆ ਮੈਂ ਕੋਈ ਵੀ ਇੰਟਰਨੈਟ ਦੀ ਰੈਸਪੀ ਇਸ ਲਈ ਨਹੀਂ ਲਈ ਕਿਉਂਕਿ ਹਰ ਕਿਸੇ ਦਾ ਸਵਾਦ ਅਲੱਗ ਅਲੱਗ ਹੁੰਦਾ ਕਿਸੇ ਨੂੰ ਕਿਸੇ ਤਰ੍ਹਾਂ ਦਾ ਖਾਣਾ ਪਸੰਦ ਹੁੰਦਾ ਕਿਸੇ ਨੂੰ ਕਿਸੇ ਤਰ੍ਹਾਂ ਦਾ ਖਾਣਾ ਪਸੰਦ ਹੁੰਦਾ ਮੈਨੂੰ ਅਤੇ ਸਾਡੀ ਸਾਰੀ ਫੈਮਲੀ ਨੂੰ ਮੇਰੇ ਮੰਮਾ ਦੇ ਹੱਥ ਦਾ ਅਤੇ ਮੇਰੀ ਦਾਦੀ ਜੀ ਦੇ ਹੱਥ ਦਾ ਹੀ ਖਾਣਾ ਪਸੰਦ ਆ ਇਸ ਲਈ ਮੈਂ ਵੀ ਉਹਨਾਂ ਤੋਂ ਹੀ ਖਾਣਾ ਬਣਾਉਣਾ ਸਿੱਖਿਆ ਆ ਤਾਂ ਜੋ ਸਾਰਿਆਂ ਨੂੰ ਮੇਰੇ ਹੱਥ ਦਾ ਖਾਣਾ ਪਸੰਦ ਆਵੇ